ਸਟੇਸ਼ਨ ਮਾਸਟਰ ਜਲੰਧਰ ਓਕੇ ਓਕੇ ਸਰ ਮੈਂ ਟੂਰਿਸਟ ਹਾਂ ਜੀ ਮੈਂ ਜਲੰਧਰ ਵ ਆਇਆ ਸੀਗਾ ਅਤੇ ਮੈਂ ਅੱਗੇ ਹੋਰ ਜਗ੍ਹਾ ਮਤਲਬ ਵਿਜਿਟ ਕਰਨਾ ਚਾਹੁੰਦਾ ਸੀਗਾ ਐਕਸਪਲੋਰ ਕਰਨਾ ਚਾਹੁੰਦਾ ਸੀ ਜਲੰਧਰ ਤੋਂ ਆਸੇ ਪਾਸੇ ਜਾਂ ਜਲੰਧਰ ਤੋਂ ਜਿੱਥੇ ਵੀ ਹਾਂਜੀ ਹਾਂਜੀ ਅਤੇ ਮੈਨੂੰ ਤੁਸੀਂ ਕੀ ਕੀ ਤੁਸੀਂ ਦੱਸ ਸਕਦੇ ਹੋ ਕਿ ਇੱਥੋਂ ਹੋਰ ਕਿੱਥੇ ਕਿੱਥੇ ਕਨੈਕਟੀਵਿਟੀ ਹੈਗੀ ਹੈ ਜਲੰਧਰ ਤੋਂ ਮਤਲਬ ਅਸੀਂ ਕਿੱਥੇ ਕਿੱਥੇ ਜਾ ਸਕਦੇ ਹਾਂ ਕਿੱਥੇ ਕਿੱਥੇ ਸਾਨੂੰ ਟ੍ਰੇਨਸ ਅਵੇਲੇਵਲ ਨੇ ਜਲੰਧਰ ਰੇਲਵੇ ਸਟੇਸ਼ਨ ਤੋਂ ਓਕੇ ਫਿਰੋਜ਼ਪੁਰ ਨੂੰ ਵੀ ਹੈਗੀ ਸਰ

ਓਕੇ ਹਾਂਜੀ ਮੈਂ ਸਰ ਆਪਣੇ ਇੱਕ ਤਾਂ ਪਠਾਨਕੋਟ ਦਾ ਸੋਚ ਰਿਹਾ ਸੀ ਅਤੇ ਇ ਇੱਕ

ਹਾਂਜੀ ਅਤੇ ਸਰ ਜੰਮੂ ਤੋਂ ਅੱਗੇ ਅੱਗੇ ਦੀ ਕਨੈਕਟੀਵਿਟੀ ਵੀ ਮਿਲ ਜਾਵੇਗੀ ਨਾ ਉੱਥੋਂ ਦੀ ਅੱਗੇ ਵੀ ਟਰੇਨਸ ਮਿਲ ਜਾਣਗੀਆਂ ਜੇ ਆਪਾਂ ਮਤਲਬ ਸੋਰੀ ਪਠਾਨਕੋਟ ਪਹੁੰਚਦੇ ਹਾਂ ਆਪਾਂ ਪਠਾਨਕੋਟ ਤੋਂ ਮੰਨ ਲਓ ਜੰਮੂ ਜ ਜਾਣਾ ਹੋਵੇ ਅੱਛਾ ਜੀ ਓਕੇ ਓਕੇ ਠੀਕ ਹੈ ਠੀਕ ਹੈ ਅਤੇ ਸਰ ਜੇ ਫਿਰੋਜ਼ਪੁਰ ਜਾਣਾ ਹੋਵੇ ਉੱਥੇ ਸੁਣਿਆ ਉਹ ਰਟ੍ਰੀਟ ਸੈਰੇਮਨੀ ਹੁੰਦੀ ਆ ਜੀ ਫਿਰੋਜ਼ਪੁਰ ਬੋਰਡਰ ਦੇ ਉੱਤੇ ਹਾਂਜੀ ਹਾਂਜੀ ਜੋ ਬੋਰਡਰ 'ਤੇ ਹੀ ਉਤਾਰੇਗੀ ਸਾਨੂੰ ਉਹਦੇ ਲਾਗੇ ਸਟੇਸ਼ਨ ਹੈਗਾ ਕੀ ਕੀ ਨਾਮ ਦੱਸਿਆ ਸਰ ਮ ਸਟੇਸ਼ਨ ਦਾ ਹੁਸੈਨ ਹੁਸੈਨੀਵਾਲਾ ਓਕੇ ਓਕੇ ਅਤੇ ਸਰ ਇਹ ਮੋਰਨਿੰਗ 'ਚ ਟਰੇਨ ਅਵੇਲੇਬਲ ਹੈ ਹੁਸੈਨੀਵਾਲਾ ਦੇ ਲਈ ਜਾਂ ਇਵਨਿੰਗ 'ਚ ਅੱਛਾ ਜੀ ਅਤੇ ਸਰ ਏ ਸੀ ਕੋਚ ਏ ਸੀ ਸੀ ਅਵੇਲੇਬਲ ਹੋਣਗੀਆਂ ਉਹਦੇ ਵਿੱਚ ਓ ਹੋ ਅੱਛਾ ਏ ਸੀ ਨਹੀਂ ਹੈ ਉਹ ਸਰ ਫੈਮਲੀ ਨਾਲ ਫਿਰ ਔਖਾ ਹੋ ਜਾਂਦਾ ਨਾ ਸਰ ਗਰਮੀਆਂ ਦਾ ਮੌਸਮ ਆ ਅੱਛਾ ਜੀ ਟੈਕਸੀ ਕਰਕੇ ਹਾਂਜੀ ਹਾਂਜੀ ਠੀਕ ਹੈ ਸਰ ਠੀਕ ਹੈ ਜੀ ਥੈਂਕ ਯੂ ਸੋ ਮਚ ਸਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਸਰ ਥੈਂਕ